ਮੈਨੂੰ ਡਾਂਸਿੰਗ ਕਰੀਅਰ ਵਿੱਚ ਪਰਿਵਾਰ ਅਤੇ ਦੋਸਤਾਂ ਵੱਲੋਂ ਕਾਫੀ ਰੁਕਾਵਟਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਸਪਸ਼ਟਤਾ ਦੀ ਘਾਟ ਡਾਂਸਰਾਂ ਨੂੰ ਬਹੁਤ ਸਾਰੇ ਅਣਜਾਣ ਮੁਕਾਬਲੇ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਪਣੀ ਸ਼ੈਲੀ ਨੂੰ ਪ੍ਰਮੁੱਖ ਬਣਾਉਣਾ ਮੁਸ਼ਕਿਲ ਹੋ ਜਾਂਦਾ ਹੈ ਪਾਰ ਕਰਨ ਦਾ ਤਰੀਕਾ ਆਪਣੀ ਵਿਸ਼ੇਸ਼ਤਾ 'ਤੇ ਧਿਆਨ ਦਿਓ ਜਿਵੇਂ ਕਿ ਡਾਂਸ ਦੇ ਨਵੇਂ ਸਟੈਪ ਅਤੇ ਵਿਅਕਤੀਗਤ ਰੂਪ ਵੱਖ ਵੱਖ ਡਾਂਸ ਸਟਾਈਲਾਂ ਦੀਆਂ ਸਿੱਖਿਆ ਲਓ ਕਿ ਤੁਸੀਂ ਵਿਵਧਾ ਪ੍ਰਦਾਨ ਕਰ ਸਕੋ ਨਿੱਜੀ ਜੀਵਨ ਅਤੇ ਪੇਸ਼ੇ ਵਿੱਚ ਸੰਤੁਲਨ ਡਾਂਸ ਕਰਨ ਨਾਲ ਸਮਾਂ ਅਤੇ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਨਿੱਜੀ ਜੀਵਨ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਪਾਰ ਕਰਨ ਦਾ ਤਰੀਕਾ ਸਮਾਂ ਪ੍ਰਬੰਧਨ ਕਰਨਾ ਸਿੱਖੋ ਅਤੇ ਦਿਨਚਰਿਆ ਨੂੰ ਸਮਰਥਿਤ ਬਣਾਓ ਪਰਿਵਾਰ ਅਤੇ ਦੋਸਤਾਂ ਨਾਲ ਕੁਝ ਸਮਾਂ ਬਿਤਾਉਣਾ ਯਕੀਨੀ ਬਣਾਓ ਆਰਥਿਕ ਚੁਣੌਤੀਆਂ ਡਾਂਸਰਾਂ ਨੂੰ ਕਈ ਵਾਰ ਆਰਥਿਕ ਸਹਾਇਤਾ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਜਦੋਂ ਉਹ ਸ਼ੁਰੂਆਤ ਕਰ ਰਹੇ ਹੁੰਦੇ ਅਤੇ ਇਸ ਨੂੰ ਪਾਰ ਕਰਨ ਦਾ ਤਰੀਕਾ ਹੋਰ ਆਰਥਿਕ ਸਰੋਤਾਂ ਦੀ ਜਾਂਚ ਕਰੋ ਜਿਵੇਂ ਕਿ ਵੋਟਿੰਗ ਕਾਰਜ ਦਾ ਪ੍ਰਦਰਸ਼ਨ ਆਰਟ ਫੰਡਿੰਗ ਜਾਂ ਸਿਪਾਰਸ਼ਿਪ ਦੇ ਕੁਛ ਮੌਕਿਆਂ ਤੱਕ ਪਹੁੰਚੋ ਮਾਨਸਿਕ ਸਿਹਤ ਤਣਾਅ ਅਤੇ ਮਨੋਵਿਗਿਆਨਿਕ ਚੁਣੌਤੀਆਂ ਅਕਸਰ ਲੋਕਾਂ ਦੀਆਂ ਕਲਾਕਾਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਪਾਰ ਕਰਨ ਦਾ ਤਰੀਕਾ ਆਪਣੇ ਦੋਸਤਾਂ ਜਾਂ ਪ੍ਰੋਫੈਸ਼ਨਲ ਨਾਲ ਗੱਲ ਕਰੋ ਜੋ ਤੁਹਾਨੂੰ ਸਮਰਥਨ ਦੇ ਸਕਦੇ ਹਨ ਭਵਿੱਖ ਦੇ ਮੌਕੇ ਕਈ ਵਾਰ ਮੁਕਾਬਲੇ ਜਾਂ ਚਰਚਿਤ ਮੌਕੇ ਮਿਲਣ ਵਿੱਚ ਸਮਾਂ ਲੱਗਦਾ ਹੈ ਜਿਸ ਨਾਲ ਪ੍ਰਦਰਸ਼ਨ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਪਾਰ ਕਰਨ ਦਾ ਤਰੀਕਾ ਸਮਰਥਨ ਜਾਂ ਨੈਟ ਵਰਕਿੰਗ ਦੇ ਮੌਕਿਆਂ ਲਈ ਸਮਾਰੋਹਾਂ ਵਿੱਚ ਭਾਗ ਲਓ ਬਿਮਾਰੀ ਜਾਂ ਸਰੀਰਕ ਸੱਥ ਡਾਂਸਰਾਂ ਨੂੰ ਕਈ ਵਾਰ ਸਰੀਰਕ ਚੋਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਕਰੀਅਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸ ਨੂੰ ਪਾਰ ਕਰਨ ਦਾ ਤਰੀਕਾ ਆਪਣੀ ਸਿਹਤ ਦੀ ਸੰਭਾਲ ਕਰੋ ਅਤੇ ਵਿਸ਼ਰਾਮ ਲਈ ਸਮਾਂ ਕੱਢੋ ਸਹੀ ਡਾਂਸ ਤਕਨੀਕਾਂ ਅਤੇ ਸਿੱਖਿਆ ਪ੍ਰਾਪਤ ਕਰੋ ਤਾਂ ਜੋ ਸਰੀਰਕ ਚੋਟਾਂ ਤੋਂ ਬਚਿਆ ਜਾ ਸਕੇ